ਮੇਰੇ ਖ਼ਿਆਲ ਵਿੱਚ ਸਰਕਾਰ ਨਾਲ ਸਰਕਾਰ ਨਾਲ ਬਹੁਤ ਸੰਸਥਾਵਾਂ ਹਨ ਜੋ ਕਿ ਸਾਡੇ ਮੰਡੀ ਦੇ ਰੇਟ ਬੰਨ੍ਹੇ ਜਾਂਦੇ ਹਨ ਅਤੇ ਸਾਨੂੰ ਚੰਗੇ ਬੀਜ ਸਰਕਾਰ ਸਬਸਿਡੀਆਂ 'ਤੇ ਭੇਜਦੀ ਹਨ ਸਰਕਾਰ ਸਾਨੂੰ ਹੋਰ ਵੀ ਸੰਦਾਂ ਲਈ ਵੀ ਖੇਤੀਬਾੜੀ ਦੇ ਸੰਦਾਂ ਲਈ ਸਾਨੂੰ ਸਬਸਿਡੀ ਅਤੇ ਬੈਂਕਾਂ ਰਾਹੀਂ ਪੈਸੇ ਦਵਾਉਂਦੇ ਹਨ ਕਿ ਅਸੀਂ ਉਹ ਸੰਦ ਖਰੀਦ ਕੇ ਆਪਣੀ ਖੇਤੀਬਾੜੀ ਬਹੁਤ ਵਧੀਆ ਢੰਗ ਦੇ ਨਾਲ ਚਲਾਉਂਦੇ ਹਨ ਸਰਕਾਰ ਤੋਂ ਬਗੈਰ ਜਿੰਮੀਦਾਰ ਦਾ ਕੋਈ ਮਸਲਾ ਹੱਲ ਨਹੀਂ ਹੁੰਦਾ